ਜਦੋਂ ਅਸੀਂ ਆਪਣੇ ਬੱਚਿਆਂ ਨੂੰ ਸਕੂਲ 'ਚ ਦਾਖਲਾ ਦਿਵਾਉਣ ਲੈ ਕੇ ਜਾਂਦੇ ਹਾਂ ਤਾਂ ਉਦੋਂ ਸਾਨੂੰ ਫੀਸ ਦੇ ਢਾਂਚੇ ਦਾ ਪਤਾ ਲੱਗਦਾ ਫੀਸ ਦੇ ਢਾਂਚੇ ਦਾ ਮਤਲਬ ਹੁੰਦਾ ਹੈ ਫੀਸ ਸਟੱਕਚਰ ਮਤਲਬ ਕਿ ਪਹਿਲੇ ਤੌਰ 'ਤੇ ਜਦੋਂ ਬੱਚਾ ਨਵੇਂ ਸਕੂਲ 'ਚ ਦਾਖਲ ਹੁੰਦਾ ਹੈ ਤਾਂ ਉਹਨੂੰ ਐਂ ਉਹਨੂੰ ਦਿੱਤਾ ਜਾਂਦਾ ਹੈ ਐਡਮੀਸ਼ਨ ਚਾਰਜ ਅਸੀਂ ਉਹਨੂੰ ਕਹਿੰਦੇ ਹਾਂ ਦਾਖਲੇ ਦੀ ਫੀਸ ਉਹ ਦਾਖਲੇ ਦੀ ਫੀਸ ਦੇ ਨਾਲ ਨਾਲ ਇੱਕ ਸਕਿਓਰਟੀ ਫੰਡ ਹੁੰਦਾ ਹੈ ਜਦੋਂ ਬੱਚਾ ਕਿਸੇ ਕਾਰਨ ਤੋਂ ਸਕੂਲ ਛੱਡ ਕੇ ਜਾਂਦਾ ਹੈ ਤਾਂ ਉਹ ਸਕਿਓਰਟੀ ਫੰਡ ਉਹਨੂੰ ਵਾਪਸ ਮਿਲਦਾ ਹੈ ਇਹਦੇ ਵਿੱਚ ਇੱਕ ਚੀਜ਼ ਹੋਰ ਹੈ ਜਿਹਨੂੰ ਕਹਿੰਦੇ ਹਾਂ ਮੰਥਲੀ ਫੀ ਕਿ ਮਹੀਨੇ ਦੀ ਫੀਸ ਉਹ ਮਹੀਨੇ ਦੀ ਫੀਸ ਕੁਝ ਸਕੂਲ ਅਤੇ ਦੋ ਮਹੀਨੇ ਬਾਅਦ ਲੈਂਦੇ ਹਨ ਕੁਛ ਮਹੀਨੇ ਦੇ ਨਾਲ ਹੀ ਲੈ ਲੈਂਦੇ ਹਨ ਇਹਦੇ ਨਾਲ ਨਾਲ ਜਦੋਂ ਸਕੂਲਾਂ ਵਿੱਚ ਇਮਤਿਹਾਨ ਹੁੰਦੇ ਹਨ ਉਹਨਾਂ ਨੂੰ ਕੁਆਟਰਲੀ ਫੰਡ ਕਹਿੰਦੇ ਹਾਂ ਉਹ ਕੁਆਟਰਲੀ ਫੰਡ ਵੀ ਲਿੱਤੇ ਜਾਂਦੇ ਹਨ ਸਕੂਲ ਦੀ ਡਾਇਰੀ ਹੁੰਦੀ ਹੈ ਉਹਦਾ ਵੀ ਪੰਜਾਹ ਸੌ ਰੁਪਇਆ ਉਹ ਰੱਖਦੇ ਨੇ ਜਿਹੜੇ ਬੱਚਿਆਂ ਨੂੰ ਉਹ ਆਈਡੈਂਟੀਟੀ ਕਾਰਡ ਦਿੰਦੇ ਨੇ ਉਹਦਾ ਵੀ ਪੰਜੀ ਤੀਹ ਰੁਪਏ ਚਾਰਜ ਕਰਦੇ ਨੇ ਬਸ ਇਹੋ ਜਿਹੀਆਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਸਕੂਲ ਦੀ ਫੀਸ ਦਾ ਢਾਂਚਾ ਤਿਆਰ ਹੋ ਜਾਂਦਾ ਹੈ